ਉੱਦਾਂ ਤਾਂ ਸਾਡੇ ਕਈ ਰਿਸ਼ਤੇਦਾਰ ਪਿੰਡਾਂ ਦੇ ਵਿੱਚ ਰਹਿੰਦੇ ਹੈਗੇ ਆ ਇੱਕ ਸਾਡੇ ਕੋਲ ਹੀ ਪਿੰਡ ਟਾਂਡਾ ਜਲੰਧਰ ਤੋਂ ਘੰਟਾ ਪੋਣਾ ਘੰਟਾ ਬਾਈਕ 'ਤੇ ਲੱਗਦਾ ਹੈਗਾ ਅਸੀਂ ਉਹਨਾਂ ਦੇ ਘਰ ਜਾਂਦੇ ਹੈਗੇ ਹਾਂ ਉਹ ਸਾਲ ਬਾਅਦ ਵੈਸੇ ਮੇਲਾ ਵੀ ਕਰਦੇ ਆ ਅਤੇ ਉੱਦਾਂ ਵੀ ਸਾਡਾ ਗੇੜਾ ਦੋ ਚਾਰ ਵਾਰੀ ਲੱਗ ਹੀ ਜਾਂਦਾ ਸਾਲ ਦੇ ਵਿੱਚ ਉਹਨਾਂ ਦੀਆਂ ਸਬਜ਼ੀਆਂ ਸਾਗ ਹੋਇਆ ਕੋਈ ਹੋਰ ਜਦੋਂ ਲੱਗਦਾ ਤਾਂ ਸਾਨੂੰ ਫੋਨ ਕਰ ਦਿੰਦੇ ਫਿਰ ਸਾ ਅਸੀਂ ਜਾ ਕੇ ਅਸੀਂ ਜ਼ਿਆਦਾਤਰ ਪਿੰਡ ਦਾ ਹੀ ਸਾਗ ਖਾਂਦੇ ਹਾਂ ਅਤੇ ਉਹ ਦੁੱਧ ਲੱਸੀ ਫਿਰ ਜਾ ਕੇ ਸਾਰੇ ਬੱਚੇ ਬੜਾ ਖੁਸ਼ ਹੋ ਕੇ ਪੀਂਦੇ ਹੈਗੇ ਆ ਬਹੁਤ ਵਧੀਆ ਲੱਗਦਾ ਪਿੰਡ ਦਾ ਮਾਹੌਲ ਸਵੇਰੇ ਸਵੇਰੇ ਉਹਨਾਂ ਨੇ ਨਵਾਂ ਘਰ ਪਾਇਆ ਹੈਗਾ ਸਵੇਰੇ ਸਵੇਰੇ ਕੋਠੇ 'ਤੇ ਚੜ੍ਹ ਕੇ ਬੱਚੇ ਬਹੁਤ ਹੀ ਅੱਛਾ ਫੀਲ ਕਰਦੇ ਹੈਗੇ ਖੇਤਾਂ ਵਿੱਚ ਵੀ ਕਈ ਵਾਰ ਚਲੇ ਜਾਂਦੇ ਸਬਜ਼ੀਆਂ ਸੁਬਜੀਆਂ ਤੋੜ ਕੇ ਨਾਲ ਲੈ ਆਉਂਦੇ ਹੈਗੇ ਉਹਨਾਂ ਦੇ ਫਿਰ ਅਸੀਂ ਲੈ ਕੇ ਆਨੇ ਘਰ ਵੀ ਕਾਫੀ